ਜਿਵੇਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈਗਾ ਵੀ ਜਿਵੇਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈਗਾ ਵੀ ਸ਼ਹਿਰਾਂ ਦੇ ਵਿੱਚ ਆਪਦੀ ਸਿਹਤ ਨੂੰ ਬਹੁਤ ਹੀ ਜ਼ਿਆਦਾ ਸੰਭਾਲ ਕੇ ਰੱਖਦੇ ਹੈਗੇ ਜਾਂ ਸਕਿਨ ਟਾਈਨ ਹੋਣ ਤੋਂ ਜਾਂ ਫਿਰ ਵੀ ਮਾੜੀ ਮੋਟੀ ਬਿਮਾਰੀ ਹੋਵੇ ਉਹਦੀ ਡਾਕਟਰੀ ਇਲਾਜ ਕਰਾਉਂਦੇ ਪਰ ਪਿੰਡਾਂ ਦੇ ਵਿੱਚ ਇਹ ਚੀਜ਼ ਨਹੀਂ ਚਲਦੀ ਪਿੰਡਾਂ ਦੇ ਵਿੱਚ ਕੋਈ ਵੀ ਮਾੜੀ ਮੋਟੀ ਜਿਵੇਂ ਬੁਖਾਰ ਹੋ ਗਿਆ ਜਾਂ ਖੰਗ ਜੁਖਾਮ ਹੋ ਗਿਆ ਅਤੇ ਜਿਹੜੀ ਵੀ ਘਰੇ ਗੋਲੀ ਦਵਾਈ ਪਈ ਹੁੰਦੀ ਹੈਗੀ ਤਾਂ ਉਹ ਲੈ ਕੇ ਡੰਗ ਸਾਰ ਲੈਂਦੇ ਉਹ ਵੀ ਤੁਰੇ ਫਿਰਦੇ ਹੈਗੇ ਪਿੰਡਾਂ ਦੇ ਵਿੱਚ ਇਹ ਚੀਜ਼ ਵੀ ਜ਼ਿਆਦਾ ਮੈਂ ਕਹਿੰਦੀ ਮਾਈਟਰ ਨਹੀਂ ਕਰਦਾ ਹੈਗਾ ਵੀ ਮਾੜੀ ਮੋਟੀ ਬਸ ਗੋਲੀ ਲੈਣ ਨਾਲ ਵੀ ਉਹ ਸਹੀ ਹੋ ਜਾਂਦੇ ਹੈਗੇ ਅਤੇ ਜਿਹੜੇ ਸ਼ਹਿਰਾਂ ਦੇ ਵਿੱਚ ਹੈਗਾ ਆਪਣਾ ਅਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਜਦੋਂ ਹੀ ਉਸਨੂੰ ਮਾੜਾ ਜਿਹਾ ਬੁਖਾਰ ਹੋਇਆ ਜਾਂ ਫਿਰ ਕੋਈ ਵੀ ਮਾੜੀ ਖੰਗ ਜੁਖਾਮ ਹੋਈ ਹੈਗੀ ਤਾਂ ਉਹਦੀ ਡਾਕਟਰੀ ਇਲਾਜ ਕਰਾਉਂਦੇ ਹੈਗੇ ਉਹਦੇ ਡਾਕਟਰ ਦੇ ਕੋਲ ਲੈ ਕੇ ਜਾਂਦੇ ਆ ਉਹਨੂੰ ਉਹਦੇ ਡਾਕਟਰ ਦੇ ਕੋਲ ਜਾ ਕੇ ਉਸਨੂੰ ਚੈਕਅੱਪ ਕਰਾਉਂਦੇ ਉਹਦਾ ਵੀ ਵੀ ਜਿਵੇਂ ਬੁਖਾਰ ਹੈ ਥੋੜ੍ਹਾ ਜਿਹਾ ਵੀ ਕਿੰਨਾ ਬੁਖਾਰ ਹੈਗਾ ਬੁਖਾਰ ਦੀ ਦਵਾਈ ਦਿਵਾਉਂਦੇ ਆ ਨਵੀਂ ਦਵਾਈ ਦਵਾ ਕੇ ਉਸਨੂੰ ਉਹ ਫਿਰ ਦਵਾਈ ਲੈਂਦਾ ਹੈ ਅਤੇ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਤਾਂ ਕੋਈ ਗੌਰਦਾ ਨਹੀਂ ਬਸ ਐਵੇਂ ਤੁਰਿਆ ਫਿਰਦਾ ਹੈਗਾ ਅਤੇ ਸ਼ਹਿਰਾਂ ਪਿੰਡਾਂ ਦੇ ਵਿੱਚ